ਮੈਂ ਫੌਜ ਦੇ ਵਿੱਚੋਂ ਛੁੱਟੀ ਆਇਆ ਸੀ ਗਰਮੀ ਦਾ ਮਹੀਨਾ ਸੀ ਪਿੰਡ ਵਿੱਚ ਰਹਿੰਦੇ ਸੀ ਯਾਰ ਮਿੱਤਰ ਦੂਜਿਆਂ ਤੇ ਵੀ ਆਪਾਂ ਬਠਿੰਡੇ ਚੱਲੀਏ ਝੀਲਾਂ ਦੇ ਵਿੱਚ ਨਹਾਉਣ ਝੀਲਾਂ ਬਠਿੰਡੇ ਥਰਮਲ ਪਲਾਂਟ ਦੀਆਂ ਬਹੁਤ ਵੱਡੀਆਂ ਝੀਲਾਂ ਹਨ ਅਸੀਂ ਉੱਥੇ ਚਲੇ ਗਏ ਉੱਥੇ ਅਨੁਭਵ ਕੀਤਾ ਵੀ ਯਾਰ ਤੈਰਨਾ ਜਾਣਦੇ ਨਹੀਂ ਕਿਵੇਂ ਤਰਿਆ ਜਾਊਗਾ ਛਾਲਾਂ ਮਾਰਨ ਲੱਗ ਗਏ ਕਿਸ਼ਤੀ ਵਾਲੇ ਨੂੰ ਪਹਿਲਾਂ ਅਨੁਭਵ ਕੀਤਾ ਕਿ ਬਈ ਤੂੰ ਸਾਡੀ ਮਦਦ ਕਰਨੀ ਹੈ ਉਹਨੇ ਕੀ ਕੀਤਾ ਅਸੀਂ ਤਾਰੀ ਜਦੋਂ ਲਾਉਣ ਲੱਗ ਗਏ ਆਪਣੀ ਕਿਸ਼ਤੀ ਦੇ ਵਿੱਚ ਇੱਕ ਮਨੋਰੰਜਨ ਦੇ ਲਈ ਛੋਟੇ ਛੋਟੇ ਸਪੀਕਰ ਲੱਗੇ ਨੇ ਹੁਣ ਵੀ ਹੈਗੇ ਨੇ ਤਾਰੀ ਦੇ ਵਿੱਚ ਉਹ ਝੀਲਾਂ ਦੇ ਵਿੱਚ ਉਹ ਲਾਉਂਦੇ ਨੇ ਪਰ ਪੈਸੇ ਜ਼ਰੂਰ ਲੈਂਦੇ ਨੇ ਇਸ ਵਿੱਚ ਤਾਰੀ ਦੀ ਕੋਈ ਦੌੜ ਤਾਂ ਨਹੀਂ ਹੋਈ ਪਰ ਅਸੀਂ ਇੱਥੇ ਤੱਕ ਐਂ ਗਏ ਕਿ ਯਾਰ ਚੱਲ ਠੰਡਾ ਪਾਣੀ ਆ ਨਹਾ ਆਵਾਂਗੇ ਪਰ ਨਹਾਉਣ ਤੋਂ ਬਾਅਦ ਪੈਸੇ ਦੇ ਕੇ ਵੀ ਮਨੋਰੰਜਨ ਕਰਕੇ ਆ ਗਏ ਜਦੋਂ ਅਸੀਂ ਪਿੰਡ ਆਉਣ ਲੱਗੇ ਤਾਂ ਉਦੋਂ ਜ਼ਿਆਦਾ ਵੀ ਸਾਡੀ ਹਾਲਤ ਖ਼ਰਾਬ ਹੋ ਗਈ ਤ ਤਾਰੀ ਤਾਂ ਪਿੰਡ ਦੀ ਵਧੀਆ ਹੁੰਦੀ ਹੈ ਜੇ ਕੋਈ ਹੋਵੇ ਜਾਂ ਸਰਕਾਰ ਕੋਈ ਦੇਵੇ ਇੱਥੇ ਤਾਰੀ ਵਾਸਤੇ ਯੁਵਾ ਬੱਚਿਆਂ ਵਾਸਤੇ ਕੁਛ ਡੰਪ ਬਣਾਏ ਜਾਣ ਨਾ ਆਪਣਾ ਸ ਝੀਲਾਂ ਜਾਂ ਗ ਜਿਵੇਂ ਹੁਣ ਗਰਾਊਂਡ ਦਿੰਦੇ ਨੇ ਇਵੇਂ ਜਿਵੇਂ ਕੋਈ ਤਾਰੀ ਵਾਸਤੇ ਦਿੱਤਾ ਜਾਵੇ ਝੀਲ ਬਣਾਈ ਜਾਵੇ ਤਾਂ ਠੀਕ ਹੈ ਉਹ ਤਾਂ ਹੁਣ ਉਦੋਂ ਵੀ ਜ਼ਿਆਦਾ ਅਸੀਂ ਤਾਂ ਮੁੜ ਕੇ ਆਏ ਜਦੋਂ ਮੁੜਕੋ ਮੁੜਕੀ ਹੋ ਗਏ ਉੱਥੇ ਦਾ ਜਿਹੜਾ ਮਾਹੌਲ ਸੀ ਉਹ ਵਧੀਆ ਸੀ ਅਤੇ ਸਾਨੂੰ ਤਾਂ ਇਹ ਹੀ ਲੱਗਿਆ ਵੀ ਯਾਰ ਇਹ ਸਰਕਾਰਾਂ ਨੂੰ ਆਖੀਏ ਵੀ ਕੋਈ ਮਨੋਰੰਜਨ ਵਾਸਤੇ ਜਿਵੇਂ ਗਰਾਉਂਡ ਦਿੰਦੀਆਂ ਨੇ ਜਵਾਕਾਂ ਵਾਸਤੇ ਤਾਰੀ ਵਾਸਤੇ ਵੀ ਸਕੂਲਾਂ ਦੇ ਵਿੱਚ ਕੋਈ ਕਨਾਲ ਦੋ ਕਨਾਲ ਦਾ ਸਵਿਮਿੰਗ ਪੂਲ ਬਣਾਇਆ ਜਾਵੇ ਤਾਂ ਕੋਈ ਉੱਥੇ ਤੋਂ ਬਚਪਨ ਤੋਂ ਹੀ ਸਿੱਖ ਕੇ ਜਾਣ ਅਤੇ ਵੱਡੇ ਹੋ ਕੇ ਉਹਨਾਂ ਨੂੰ ਕੋਈ ਇਹੋ ਜਿਹੀ ਦਿੱਕਤ ਨਾ ਆਵੇ